ਆਵਾਜਾਈ ਦੇ ਸਾਧਨਾਂ ਦੀ ਘਾਟ ਕਰਕੇ ਕਾਫ਼ੀ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਜਿਵੇਂ ਕਿ ਅਸੀਂ ਦੇਖਾਂਗੇ ਸਿੱਖਿਆ ਸਿੱਖਿਆ ਦੇ ਮਾਮਲੇ ਦੇ ਵਿੱਚ ਜਿਵੇਂ ਕਿ ਕਈ ਬੱਚੇ ਪੇਂਡੂ ਥਾਂ ਤੋਂ ਸ਼ਹਿਰ ਥਾਂ ਪੜ੍ਹਨ ਆਉਂਦੇ ਹਨ ਤਾਂ ਉਹਨਾਂ ਨੂੰ ਬੱਸਾਂ ਵਿੱਚ ਸਫ਼ਰ ਕਰਨਾ ਪੈਂਦਾ ਹੈ ਕਈ ਵਾਰੀ ਬੱਸਾਂ ਲੇਟ ਹੋ ਜਾਂਦੀਆਂ ਹਨ ਤਾਂ ਉਹਨਾਂ ਦੀ ਪੜ੍ਹਾਈ 'ਤੇ ਵੀ ਅਸਰ ਹੁੰਦਾ ਹੈ ਜਿਸ ਕਰਕੇ ਉਹ ਆਪਣੇ ਲੈਕਚਰ 'ਚ ਲੇਟ ਪਹੁੰਚਦੇ ਹਨ ਜਾਂ ਵਾਪਸੀ ਦੇ ਟਾਈਮ ਬੱਸਾਂ ਨਾ ਟਾਈਮ 'ਤੇ ਆਉਣ ਕਰਕੇ ਉਹਨਾਂ ਨੂੰ ਦੇਰ ਰਾਤ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ ਜਾਂ ਅੱਜ ਕੱਲ੍ਹ ਕਾਫ਼ੀ ਸਾਰੀਆਂ ਹੜਤਾਲਾਂ ਹੋਣ ਦੇ ਕਾਰਨ ਸਰਕਾਰਾਂ ਦੀਆਂ ਆਪਸੀ ਆਪਸੀ ਪਰੇਸ਼ਾਨੀ ਹੋਣ ਦੇ ਕਾਰਨ ਨਾ ਬੱਸਾਂ ਦੀ ਹੜਤਾਲ ਹੋ ਜਾਂਦੀ ਹੈ ਬੱਸਾਂ ਆਪਣੇ ਸਮੇਂ ਸਿਰ ਨਹੀਂ ਆਉਂਦੀਆਂ ਹਨ ਕਾਫ਼ੀ ਲੋਕਾਂ ਦਾ ਇਸ 'ਤੇ ਪ੍ਰਭਾਵ ਪੈਂਦਾ ਹੈ ਸਿਹਤ ਸੰਭਾਲ ਦੇ ਵਿੱਚ ਜੇ ਆਪਾਂ ਦੇਖੀਏ ਜੇ ਰਾਤ ਨੂੰ ਕੋਈ ਪਰੇਸ਼ਾਨੀ ਆ ਜਾਂਦੀ ਹੈ ਕਿਸੇ ਦੇ ਘਰ ਕੋਈ ਪ੍ਰੋਬਲਮ ਹੋ ਜਾਂਦੀ ਹੈ ਕੋਈ ਪ੍ਰੇਸ਼ਾ ਕੋਈ ਬਿਮਾਰ ਪੈ ਜਾਂਦਾ ਹੈ ਤਾਂ ਰਾਤ ਨੂੰ ਆਵਾਜਾਈ ਦੇ ਸਾਧਨਾਂ ਦੀ ਕਾਫ਼ੀ ਘਾਟ ਹੁੰਦੀ ਹੈ ਜਿਸ ਕਾਰਨ ਕਈ ਲੋਕਾਂ ਨੂੰ ਪਿੰਡ ਥਾਂ ਵਿੱਚ ਜ਼ਿਆਦਾਤਰ ਯ ਦੇਖਿਆ ਜਾ ਸਕਦਾ ਹੈ ਕਿ ਲੋਕ ਆਪਣਾ ਆਪਣੇ ਪਰਿਵਾਰ ਦੇ ਜਿਹੜਾ ਮੈਂਬਰ ਬਿਮਾਰ ਹੈ ਉਹਨੂੰ ਸਮੇਂ ਸਿਰ ਹਸਪਤਾਲ ਨਾ ਲਿਜਾਣ ਖੋ ਦਿੰਦੇ ਹਨ ਸਿੱਖਿਆ ਜਾਂ ਨੌਕਰੀ ਦੇ ਵਿੱਚ ਵੀ ਦੇਖਿਆ ਜਾਂਦਾ ਹੈ ਕਈ ਕਈ ਥਾਂ 'ਤੇ ਜਿਹੜੇ ਮੁਲਾਜ਼ਮ ਹੁੰਦੇ ਹਨ ਦੂਰੋਂ ਆਉਂਦੇ ਹਨ ਦੂਰ ਥਾਂ ਤੋਂ ਉਹਨਾਂ ਦਾ ਆਉਣ ਕਰਕੇ ਉਹਨਾਂ ਦਾ ਉਹ ਟਾਈਮ 'ਤੇ ਨਾ ਪਹੁੰਚ ਸਕਦੇ ਹਨ ਕਈ ਵਾਰੀ ਵੈਲ ਗੱਡੀਆ ਜਾਂ ਬੱਸਾਂ ਲੇਟ ਹੋ ਜਾਂਦੀਆਂ ਹਨ ਜਿਸ ਕਰਕੇ ਉਹ ਘਰ ਲੇਟ ਪਹੁੰਚਦੇ ਹਨ ਇਸ ਕਰਕੇ ਆਪਾਂ ਦੇਖ ਸਕਦੇ ਹਾਂ ਕਿਸ ਜਿਹੜਾ ਕਿਫਾਇਤੀ ਆਵਾਜਾਈ ਦੀ ਘਾਟ ਕਰਕੇ ਵੀ ਸਾਡੀ ਸਿੱਖਿਆ ਅਤੇ ਨੌਕਰੀ 'ਤੇ ਜਾਂ ਸਿਹਤ ਸੰਭਾਲ 'ਤੇ ਕਾਫੀ ਜ਼ਿਆਦਾ ਪ੍ਰਭਾਵ ਪੈਂਦਾ ਹੈ ਧੰਨਵਾਦ